ਪੰਜਾਬ ਵਿੱਚ ਕੰਪਨੀਆਂ ਦੁਆਰਾ ਵਿਕਸੀਤ ਜਾਂ ਪ੍ਰਦਾਨ ਕੀਤੀਆਂ ਗਈਆਂ ਪ੍ਰਮੁੱਖ ਟੈਕਨੋਲਜੀ ਉਤਪਾਦ ਅਤੇ ਸੇਵਾਵਾਂ ਹਨ ਜੋ ਜਿਵੇਂ ਕਿ ਸੋਫਟਵੇਅਰ ਹਾਰਡਵੇਅਰ ਅਤੇ ਆਉਟਸੋਰਸਿੰਗ ਇਹਨਾਂ ਟੈਕਨੀਕਸ ਦੇ ਨਾਲ ਜੋ ਕਿ ਕਈ ਕੰਪਨੀਆਂ ਨੇ ਉਹ ਵੈੱਬ ਡਿਵੈਲਪਮੈਂਟ ਕਰਦੀਆਂ ਨੇ ਆਰਟ ਵਰਕ ਸਰਵਿਸ ਦਿੰਦੀਆਂ ਸਰਵਿਸਿਸ ਦਿੰਦੀਆਂ ਨੇ ਅਤੇ ਕੁਝ ਈ ਕਮਰਸ ਦੀਆਂ ਸਰਵਿਸ ਦਿੰਦੀਆਂ ਨੇ ਸਾਈਬਰ ਸਿਕਿਉਰਟੀ ਪ੍ਰਦਾਨ ਕਰਦੀਆਂ ਨੇ ਡੇਟਾਬੇਸ ਮੈਨੇਜਮੈਂਟ ਕਰਦੀਆਂ ਨੇ ਇਹ ਸਾਡੇ ਸਰ ਪੰਜਾਬ ਦਾ ਜਿਵੇਂ ਕੁਝ ਲੋਕਾਂ ਦਾ ਡੇਟਾਬੇਸ ਨੂੰ ਸੇ ਡੇਟਾ ਨੂੰ ਸੇਵ ਕਰਨ ਲਈ ਕੁਝ ਡੇਟਾਬੇਸ ਸ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਨੇ ਸਾਈਬਰ ਸਿਕਿਉਰਟੀ ਦਿੰਦੀਆਂ ਨੇ ਉਹਨਾ ਦੇ ਡੇਟਾ ਨੂੰ ਲੀਕ ਹੋਣ ਤੋਂ ਬਚਾਉਂਦੀਆ ਨੇ ਅਤੇ ਕੁਝ ਈ ਕਮਰਸ ਦੀਆਂ ਸਾਈਟਸ ਹੁੰਦੀਆਂ ਨੇ ਜੋ ਕਿ ਲੋਕਾਂ ਨੂੰ ਬਿਜ਼ਨਸ ਕਰਨ ਲਈ ਵੀ ਮਦਦ ਕਰਦੀਆਂ ਹਨ ਆਨਲਾਈਨ ਬਿਜ਼ਨਸ ਕਰਵਾਉਂਦੀਆਂ ਨੇ ਅਤੇ ਇਹਨਾਂ ਬਿਜ਼ਨਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਅਤੇ ਇਹ ਲੋਕ ਅੱਗੇ ਤਰੱਕੀ ਕਰਦੇ ਹਨ ਇਹਨਾਂ ਤ ਤਕਨੀਕਾਂ ਦੇ ਨਾਲ ਪੰਜਾਬ ਵਿੱਚ ਬਹੁਤ ਵਿਕਾਸ ਹੁੰਦਾ ਹੈ ਕਈ ਲੋਕ ਘਰ ਬੈਠੇ ਬੈਠੇ ਔਨਲਾਈਨ ਬਿਜ਼ਨਸ ਕਰਦੇ ਨੇ ਫ੍ਰੀਲਾਂਸਿੰਗ ਜੋਬਸ ਪ੍ਰੋਵਾਈਡ ਕਰਦੀਆਂ ਹਨ ਇਹਨਾਂ ਟੈਕਨੀਕਸ ਦੇ ਨਾਲ ਅਤੇ ਲੋਕਾਂ ਦੇ ਵਿੱਚ ਇਸ ਦੀ ਜਾਗਰੂਕਤਾ ਹੋਰ ਵੀ ਵੱਧਦੀ ਜਾ ਰਹੀ ਹੈ ਅਤੇ ਲੋਕ ਜੋ ਹੈ ਇਸ ਟੈਕਨੋਲਜੀ ਨੂੰ ਬਹੁਤ ਸੋਫਟਵੇਅਰ ਬਣਵਾਉਂਦੇ ਨੇ ਹਾਰਡਵੇਅਰ ਚੀਜ਼ਾਂ ਦੇ ਨੇ ਕਈ ਆਊਟਸੋਰਸਿੰਗ ਹੁੰਦੇ ਕਈ ਥਰਡ ਪਾਰਟੀ ਤੋਂ ਆਪਣਾ ਕੰਮ ਕਰਵਾਉਂਦੇ ਨੇ ਅਤੇ ਬਹੁਤ ਜ਼ਿਆਦਾ ਵੈਬ ਡਿਵੈਲਪਮੈਂਟ ਦੇ ਵਿੱਚ ਯੂਜ ਕਰਦੇ ਕੋਈ ਆਪਣੀ ਵੈਬਸਾਈਟ ਡਿਵਾ ਡਿਜ਼ਾਇਨ ਕਰਵਾਉਂਦੇ ਨੇ ਧੰਨਵਾਦ